ਮੈਂ ਮੋਬਾਇਲ ਗੇਮਿੰਗ ਦੇ ਬਾਰੇ ਇਸ ਤਰ੍ਹਾਂ ਸੋਚਦੀ ਹਾਂ ਕਿ ਇਹਨੇ ਇਸ ਤਰ੍ਹਾਂ ਸਮੁੱਚੇ ਉਦਯਾ ਉਦਯੋਗ ਨੂੰ ਪ੍ਰਭਾਵਿਤ ਕੀਤਾ ਹੈ ਕਿ ਜਿਵੇਂ ਅਸੀਂ ਅਸੀਂ ਛੋਟੇ ਸੀਗੇ ਅਤੇ ਅਸੀਂ ਆਪਣੇ ਬਚਪਨ ਵਿੱਚ ਆਪਣੇ ਦੋਸਤਾਂ ਨਾਲ ਸੰਪਰਕ 'ਚ ਰਹਿੰਦੇ ਸੀ ਅਸੀਂ ਬਾਹਰ ਮਿੱਟੀਆਂ 'ਚ ਖੇਡਦੇ ਸੀ ਸਾਡੀ ਗੇਮ ਹੁੰਦੀ ਸੀ ਸਟੈਪੂ ਅਸੀਂ ਸਾਈਕਲ ਚਲਾਉਣ ਵਾਸਤੇ ਮਿਲਦੇ ਸੀ ਸਾਡੀ ਹੀ ਲੂਡੋ ਗੇਮ ਹੁੰਦੀ ਸੀ ਅਸੀਂ ਮਤਲਬ ਉਹ ਗੇਮਸ ਖੇਡਦੇ ਸੀ ਜਿਦੇ 'ਚ ਸਾਡਾ ਮੇਲ ਮਿਲਾਪ ਹੁੰਦਾ ਸੀ ਆਪਣੇ ਯਾਰ ਬੇਲੀਆਂ ਨਾਲ ਪਰ ਮੋਬਾਇਲ ਗੇਮਿੰਗ ਦੇ ਨਾਲ ਕੁਛ ਇਸ ਤਰ੍ਹਾਂ ਪ੍ਰਭਾਵ ਪਿਆ ਹੈ ਕਿ ਹੁਣ ਇੱਕ ਨਵੀਂ ਉਦਯੋਗ ਆ ਕੇ ਖੜ੍ਹਾ ਹੋ ਗਿਆ ਹੈ ਜੋ ਕਿ ਹੈ ਮੋਬਾਇਲ ਗੇਮਿੰਗ ਦਾ ਇਹਦੇ ਵਾਸਤੇ ਲੋਕਾਂ ਨੂੰ ਕਾਰੋਬਾਰ ਤਾਂ ਮਿਲਿਆ ਹੀ ਹੈ ਨਵਾਂ ਕੰਮ ਵੀ ਮਿਲਿਆ ਹੈ ਨਵੀਂ ਔਕਉਪੇਸ਼ਨ ਵੀ ਮਿਲ ਗਈ ਹੈ ਲੋਕਾਂ ਨੂੰ ਇੱਕ ਮਤਲਬ ਕੋਡਰਸ ਆ ਗਏ ਨੇ ਇਹਦੇ ਵਾਸਤੇ ਪ੍ਰੋਪਰ ਪੜ੍ਹਾਈ ਆ ਗਈ ਹੈ ਕੋਰਡਿੰਗ ਕਰਨੀ ਪੈਂਦੀ ਹੈ ਤਾਂ ਗੇਮਸ ਮੋਬਾਇਲ ਦੀ ਬਣਦੀਆਂ ਨੇ ਅਤੇ ਇਹਦੇ ਨਾਲ ਇੱਕ ਹੋਰ ਫ਼ਰਕ ਵੀ ਪਿਆ ਹੈ ਉਹ ਹੈ ਲੋਕਾਂ ਦਾ ਮੇਲ ਮਿਲਾਪ ਪਹਿਲੇ ਲੋਕ ਬਾਹਰ ਨਿਕਲਦੇ ਸੀ ਖੇਡਣ ਵਾਸਤੇ ਹੁਣ ਉਹੀ ਜਿਹੜੀ ਸਾਡੀਆਂ ਗੇਮਸ ਨੇ ਉਹ ਕੀ ਹੋ ਗਿਆ ਫੋਨ 'ਚ ਆ ਗਈਆਂ ਅਤੇ ਲੋਕ ਹੁਣ ਆਪਣੇ ਫੋਨ 'ਚ ਰੁੱਝੇ ਰਹਿੰਦੇ ਨੇ ਬਾਹਰ ਜਾਣਾ ਪਸੰਦ ਨਹੀਂ ਕਰਦੇ ਅਤੇ ਇਹਦੇ ਆਪਣੇ ਫਾਇਦੇ ਨੇ ਅਤੇ ਨੁਕਸਾਨ ਵੀ ਹੈ ਫਾਇਦਾ ਹੈ ਵੈ ਕਿ ਬਹੁਤ ਸਾਰੇ ਲੋਕਾਂ ਨੂੰ ਕਾਰੋਬਾਰ ਮਿਲ ਗਿਆ ਹੈ ਨੁਕਸਾਨ ਹੈ ਵੈ ਕਿ ਬੱਚੇ ਜਿਹੜੇ ਹੈ ਉਹਨੂੰ ਆਪਣੇ ਘਰਾਂ ਤੱਕ ਸੀਮਿਤ ਹੋ ਗਏ ਨੇ ਉਹਨਾਂ ਨੂੰ ਬਾਹਰ ਜਾ ਕੇ ਕੁਛ ਨਹੀਂ ਮਿਲਦਾ